ਉਨੱਤੀ ਫਰਵਰੀ ਦੋ ਹਜ਼ਾਰ ਵੀਹ ਦਸ ਮਾਰਚ ਦੋ ਹਜ਼ਾਰ ਇੱਕੀ ਅੱਠ ਸਤੰਬਰ ਦੋ ਹਜ਼ਾਰ ਚੌਵੀ ਨਵੰਬਰ ਉੱਨੀ ਸੌ ਨੜ੍ਹਿਨਵੇਂ ਪੱਚੀ ਦਸੰਬਰ ਦੋ ਹਜ਼ਾਰ